ਸਤਲੁਜ ਬਿਆਸ ਅਤੇ ਰਾਵੀ ਦਰਿਆ ਦੀ ਸਥਿੱਤੀ ਪੰਜਾਬ ਖੇਤਰ ਵਿੱਚ ਮੁੱਦੇ 'ਤੇ ਹਨ ਸਤਲੁਜ ਦਰਿਆ ਦੀ ਸਥਿੱਤੀ ਕਾਰਨ ਕਈ ਵਾਰ ਪਾਣੀ ਮੀਂਹ ਜ਼ਿਆਦਾ ਪੈਣ ਦੇ ਕਾਰਨ ਪਾਣੀ ਦਰਿਆ ਦੇ ਵਿੱਚ ਜ਼ਿਆਦਾ ਭਰ ਜਾਂਦਾ ਹੈ ਜਿਸ ਕਾਰਨ ਪੰ ਦਰਿਆ ਦਾ ਪਾਣੀ ਬਾਹਰ ਆ ਜਾਂਦਾ ਹੈ ਅਤੇ ਸਾਰੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਚਲ ਜਾਂਦਾ ਹੈ ਜਿਸ ਕਰਕੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਖਾਣ ਪੀਣ ਦੇ ਵਿੱਚ ਅਤੇ ਜੋ ਕਿ ਆਪਣੇ ਘਰ ਆ ਉਹ ਉੱਜੜ ਜਾਂਦੇ ਹਨ ਉਹਨਾਂ ਬੰਦਿਆਂ ਦੇ ਪਾਣੀ ਜ਼ਿਆਦਾ ਆਉਣ ਦੇ ਕਾਰਨ ਸਤਲੁਜ ਆ ਦਰਿਆ ਦੇ ਕਾਰਨ ਇਸ ਕਰਕੇ ਸਰਕਾਰ ਨੂੰ ਇਸਦਾ ਹੱਲ ਕਰਨਾ ਚਾਹੀਦਾ ਹੈ ਜੋ ਆਸ ਪਾਸ ਦੇ ਲੋਕ ਹਨ ਜਾਂ ਤਾਂ ਉਹਨਾਂ ਨੂੰ ਕਿਸੇ ਹੋਰ ਖੇਤਰ ਵਿੱਚ ਸ਼ਿਫਟ ਕਰਨਾ ਚਾਹੀਦਾ ਹੈ ਜਾਂ ਫਿਰ ਦਰਿਆ ਦੇ ਆਸ ਪਾਸ ਦਾ ਇਲਾਕਾ ਪੱਕਾ ਕਰ ਦੇਣਾ ਚਾਹੀਦਾ ਹੈ ਜਿਸ ਕਾਰਨ ਪਾਣੀ ਕਿੰਨਾ ਵੀ ਭਰ ਸਕੇ ਜੋ ਕਿ ਬਾਹਰ ਨਾ ਆਵੇ ਪਾਣੀ ਅਤੇ ਲੋਕਾਂ ਦਾ ਬਚਾਅ ਰਹੇ ਅਤੇ ਲੋਕ ਆਪਣੇ ਸੁਰੱਖਿਤ ਰਹਿਣ